ਹੈਲੋ ਹੈਲੋ ਅੰਨਾਪੂਰਨਾ ਜੀ ਮੈਂ ਰੋਡ ਤੋਂ ਬੋਲ ਰਿਹਾ ਜੀ ਤੁਹਾਡੇ ਰੈਸਟੋਰੈਂਟ ਵਿੱਚ ਐਡਵਾਂਸ ਰਿਜਰਵੇਸ਼ਨ ਅਗਰ ਕਰਵਾਉਣੀ ਹੋਵੇ ਉਹਦੇ ਵਾਸਤੇ ਕੋਈ ਸਪੈਸ਼ਲ ਤੁਹਾਡੇ ਵੱਲੋਂ ਆਫਰ ਹੈਗੀ ਹੈ ਹਾਂ ਸਾਡੇ ਇੱਕ ਛੋਟਾ ਜਿਹਾ ਫੰਕਸ਼ਨ ਹੈਗਾ ਵਾ ਪਾਰਟੀ ਕਹਿ ਲਓ ਤੁਸੀਂ ਦਸ ਬਾਰਾਂ ਜਾਣਿਆ ਦੀ ਗੈਦਰਿੰਗ ਹੋਣੀ ਹੈ ਅਤੇ ਕੱਲ੍ਹ ਸ਼ਾਮ ਦਾ ਟਾਈਮ ਸਾਨੂੰ ਚਾਹੀਦਾ ਅੱਠ ਵਜੇ ਦਾ ਅਤੇ ਅਗਰ ਅਸੀਂ ਐਡਵਾਂਸ ਬੂਕਿੰਗ ਕਰਵਾਉਂਦੇ ਹਾਂ ਤੁਹਾਡੇ ਕੋਲੋਂ ਤਾਂ ਉਹਦੇ ਵਾਸਤੇ ਤੁਹਾਡੇ ਵੱਲੋਂ ਕੋਈ ਸਪੈਸ਼ਲ ਕੋਈ ਆਫਰ ਹੈਗੀ ਆ ਕੋਈ ਡਿਸਕਾਉਂਟ ਵਗੈਰਾ ਜਾਂ ਕੋਈ ਹੋਰ ਹਾਂ ਹਾਂ ਜੇ ਜੋ ਵੀ ਆਫਰ ਹੈਗੀ ਆ ਮਤਲਬ ਥੋੜ੍ਹੀ ਜਿਹੀ ਉਹਦੀ ਮੈਨੂੰ ਡਿਟੇਲ ਭੇਜ ਦਿਓ ਮੈਨਿਊ ਵਗੈਰਾ ਤੁਸੀਂ ਭੇਜ ਦਿਓ ਅਤੇ ਹਾਂ ਹਾਂ ਵੈੱਜ ਹੀ ਚੱਲੇਗਾ ਵੈੱਜ ਨੋਨ ਵੈੱਜ ਨਹੀਂ ਸਿਰਫ ਵੈੱਜ ਦੀ ਗੱਲ ਹੈ ਜੋ ਨਾਲ ਮੈਂ ਪ੍ਰੈਪਰੇਸ਼ਨ ਤੁਹਾਡੀਆਂ ਹੈਗੀਆਂ ਨੇ ਜਿਹਦੇ ਬਾਰੇ ਮੈਂ ਪਹਿਲਾਂ ਕਾਫ਼ੀ ਸੁਣ ਵੀ ਚੁੱਕਾ ਹਾਂ ਅਤੇ ਆ ਵੀ ਚੁੱਕਾ ਤੁਹਾਡੇ ਰੈਸਟੋਰੈਂਟ ਦੇ ਵਿੱਚ ਅਤੇ ਮੈਨੂੰ ਥੋੜ੍ਹੀ ਡਿਟੇਲ ਤੁਸੀਂ ਭੇਜ ਦਿਓ ਤਾਂ ਕਿ ਮੈਂ ਮਤਲਬ ਟਾਈਮ ਦੇ ਨਾਲ ਬੁਕਿੰਗ ਆਪਣੇ ਮੈਂਬਰ ਪੁੱਜ ਜਾਣ ਸਾਡੇ ਉੱਥੇ ਪ੍ਰੋਪਰਲੀ ਸਰਵ ਕਰ ਸਕੋ ਮੇਨ ਮੇਰਾ ਪਰਪਜ ਕਾਲ ਕਰਨ ਦਾ ਇਹ ਸੀਗਾ ਕਿ ਐਡਵਾਂਸ ਰਿਜਰਵੇਸ਼ਨ 'ਤੇ ਤੁਹਾਡੇ ਵੱਲੋਂ ਕੋਈ ਸਪੈਸ਼ਲ ਔਫਰ ਹੈਗੀ ਆ ਤਾਂ ਉਹਦਾ ਅਸੀਂ ਬੈਨਫਿਟ ਲੈ ਸਕੀਏ ਠੀਕ ਹੈ ਜੀ ਉਹ ਤੁਸੀਂ ਮੈਨੂੰ ਮੈਨੂੰ ਭੇਜ ਦੇਣੀ ਠੀਕ ਹੈ ਓਕੇ ਥੈਂਕਿ ਯੂ